ਕਿਤਾਬ ਜਿਹੜੀ ਹੈ ਤੂਤਾਂ ਵਾਲੀ ਤੂਤਾਂ ਵਾਲਾ ਖੂਹ ਜਦੋਂ ਉਹ ਮੈਂ ਪੜ੍ਹੀ ਲਈ ਕਿਸੇ ਤੋਂ ਅਤੇ ਪੜ੍ਹੀ ਉਦੋਂ ਮੈਂ ਦਸ ਪੰਦਰ੍ਹਾਂ ਪੇਜ ਪੜ੍ਹੇ ਅਤੇ ਉਦ ਉਸ ਟਾਈਮ ਤੋਂ ਹੀ ਮੇਰਾ ਜਿਹੜਾ ਇੰਟਰਸਟ ਹੈ ਉਹਦੇ ਵਿੱਚ ਵੱਧਦਾ ਗਿਆ ਅੰਤ ਤੱਕ ਮੈਂ ਜਦੋਂ ਉਹਨੂੰ ਪੜ੍ਹਿਆ ਅਤੇ ਉਹਦੀ ਪੂਰੀ ਮੈਨੂੰ ਘਰ ਦੀ ਕਹਾਣੀ ਅਤੇ ਤੂਤਾਂ ਵਾਲੇ ਖੂਹ ਦੀ ਡੈਫੀਨੇਸ਼ਨ ਦਾ ਪਤਾ ਲੱਗਿਆ ਅਤੇ ਮੈਨੂੰ ਬਹੁਤ ਪਸੰਦ ਆਈ ਅਤੇ ਹੌਲੀ ਹੌਲੀ ਉਹਦੇ ਵਿੱਚ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਕਈ ਇਹ ਜਿਹੇ ਪਲ ਸੀਗੇ ਜਿਹੜੇ ਮੈਂ ਆਪਣੇ ਚੇਂਜ ਕੀਤੇ ਹੈ